ਹੈਲੋ ਹਾਂਜੀ ਸਰ ਸਤਿ ਸ਼੍ਰੀ ਅਕਾਲ ਸਰ ਤੁਹਾਡੇ ਵੀ ਸਾਡੇ ਮੇਰੀ ਫਰੈਂਡ ਆ ਇੱਕ ਉਹਨੇ ਤੁਹਾਡਾ ਨੰਬਰ ਦਿੱਤਾ ਸੀਗਾ ਅਸੀਂ ਫੋਨ ਬਾਰੇ ਪੁੱਛਣਾ ਸੀਗਾ ਫੋਨ ਖਰੀਦਣਾ ਸੀਗਾ ਫੋਨ ਸਾਨੂੰ ਫਿਰ ਨੈਟ ਪਲਸ ਦਾ ਚਾਹੀਦਾ ਹੈਗਾ ਵਨ ਐਕਸ ਪਲਸ ਦਾ ਸਾਨੂੰ ਵਨ ਮਤਲਬ ਫੋਨ ਤਾਂ ਅਸੀਂ ਵਨ ਪਲਸ ਦਾ ਲੈਣਾ ਵੀ ਜੇ ਸਾਨੂੰ ਇਸ ਤੋਂ ਵੀ ਵਧੀਆ ਹੋਰ ਫੋਨ ਮਿਲਦਾ ਹੈਗਾ ਵੀ ਸਾਨੂੰ ਦੱਸਤਾ ਦੱਸ ਦਿਉ ਵੀ ਇਹ 'ਚ ਕਿਹੜੇ ਕਿਹੜੇ ਕੁਆਲਿਟੀਆਂ ਹੋਣਗੀਆਂ ਅੱਛਾ ਫਿਰ ਥੋੜ੍ਹੀ ਮੇਰੇ ਕੈਮਰੇ ਵੀ ਇੱਕ ਪੂਰੇ ਵੀ ਸਾਫ ਹੋਣ ਅਤੇ ਸਟੋਰੇਜ ਅਗਰ ਪੂਰੀ ਫੁੱਲ ਹੋਵੇ ਨਾ ਵੀ ਮੈਂਬਰੀ ਵੀ ਜ਼ਿਆਦਾ ਰੱਖ ਸਕੇ ਹਾਂ ਸਾਨੂੰ ਕੋਈ ਹੋਰ ਕੰਪਨੀ ਵਗੈਰਾ ਦਿਖਾ ਦਿਉ ਐਮ ਆਈ ਵਿਖਾ ਦਿਉ ਜਾਂ ਕੋਈ ਹੋਰ ਹੁੰਦੀ ਆ ਅੱਜ ਕੱਲ ਤਾਂ ਕਹਿ ਰਹੇ ਵੀ ਵੀ ਸੋਲ੍ਹਾਂ ਪਰੋ ਪੰਦਰ੍ਹਾਂ ਪਰੋ ਚੱਲੀ ਜਾਂਦੇ ਹੈਗੇ ਵੀ ਉਹ ਕਿਵੇਂ ਹੈਗੇ ਫੋਨ ਹਾਂਜੀ ਇਹ ਤਾਂ ਹੈਗਾ ਹਾਂ ਹਾਂਜੀ ਚਲੋ ਵੀ ਪ੍ਰਾਈਜ਼ ਥੋੜ੍ਹਾ ਕਰਕੇ ਜ਼ਿਆਦਾ ਲੱਗ ਰਿਹਾ ਥੋੜ੍ਹਾ ਕਿ ਵੀ ਲੈਸ ਤਾਂ ਤੁਸੀਂ ਕਰੋਗੇ ਹੀ ਹਾਂਜੀ ਆਹ ਫੋਨ ਪੈਕ ਕਰ ਦਿਉ ਥੈਂਕ ਯੂ ਸੋ ਮਚ ਸਰ